ਹੈਲੋ ਐਮਾਜੋਨ ਤੋਂ ਬੋਲਦੇ ਆ ਮੈਂ ਨਾ ਦੋ ਪ੍ਰੋਡਕਟ ਮੰਗਵਾਏ ਸੀ ਇੱਕ ਤਾਂ ਚਲੋ ਮੇਰਾ ਬਹੁਤ ਵਧੀਆ ਸੀ ਅਤੇ ਇੱਕ ਪ੍ਰੋਡਕਟ ਮੈਨੂੰ ਵਧੀਆ ਨਹੀਂ ਰਿਹਾ ਉਹਦੇ ਬਾਰੇ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਦੱਸਣਾ ਚਾਹੁੰਦੀ ਹਾਂ ਵੀ ਉਹ ਸੀ ਸੋਲਰ ਸਿਸਟਮ 'ਤੇ ਚੱਲਣ ਵਾਲੀ ਕਾਰ ਅਤੇ ਜਿਹਦੇ ਵਿੱਚੋਂ ਵੀ ਉਹ ਆ ਤਾਂ ਚਲੋ ਟਾਈਮ ਨਾਲ ਹੀ ਗਈ ਸੀ ਵੀ ਮੈਨੂੰ ਮਿਲ ਗਈ ਵਧੀਆ ਸੀ ਉਹਨੂੰ ਮੈਂ ਬਾਜ਼ਾਰ 'ਚ ਇੰਨਾ ਲੱਭਿਆ ਅਤੇ ਮੈਨੂੰ ਲੱਭਦੀ ਨਹੀਂ ਸੀ ਜਦੋਂ ਮੈਂ ਤੁਹਾਡੀ ਸਾਈਡ 'ਤੇ ਵੇਖਿਆ ਉਹਨੂੰ ਤਾਂ ਮੈਨੂੰ ਬਹੁਤ ਵਧੀਆ ਲੱਗਾ ਕਿ ਹੁਣ ਮੈਂ ਉਹਨੂੰ ਮੰਗਵਾ ਸਕਦੀ ਹਾਂ ਮੇਰਾ ਬੱਚਾ ਵੀ ਬੜਾ ਖੁਸ਼ ਸੀ ਇਹ ਚੀਜ਼ ਨੂੰ ਲੈ ਕੇ ਕਿ ਮੰਮਾ ਮੰਗਵਾ ਕੇ ਦੇਣਗੇ ਮੈਨੂੰ ਕਾਰ ਅਤੇ ਜਦੋਂ ਆ ਗਈ ਮੇਰੇ ਘਰੇ ਤਾਂ ਇੱਕ ਦਿਨ ਚਲਾਈ ਠੀਕ ਚੱਲੀ ਪਰ ਬਟ ਇਹ ਸੀ ਕਿ ਉਹਦੇ ਵਿੱਚੋਂ ਮੈਨੂੰ ਉਹ ਨਾ ਤਾਂ ਉਹਦੇ ਟਾਇਰ ਵਧੀਆ ਸੀ ਉਹਦੇ ਟਾਇਰ ਵੀ ਖਰਾਬ ਸੀ ਅਤੇ ਉਹਦੀ ਪਲੇਟ ਵੀ ਉੱਤੋਂ ਟੁੱਟੀ ਹੋਈ ਸੀ ਅਤੇ ਜਿਹਦੇ ਨਾਲ ਮੇਰਾ ਬੱਚਾ ਬਹੁਤ ਰੋਂਦਾ ਸੀ ਕਿ ਮੰਮਾ ਤੁਸੀਂ ਕੀ ਮੰਗਵਾ ਦਿੱਤਾ ਮੈਨੂੰ ਅਤੇ ਉਹਦੇ ਵਾਸਤੇ ਮੈਨੂੰ ਇਹ ਚੀਜ਼ ਵਧੀਆ ਨਹੀਂ ਲੱਗੀ ਵੀ ਮੈਂ ਇਹਨੂੰ ਇੰਨਾ ਕੀ ਵਧੀਆ ਸੀ ਇਹ ਪ੍ਰੋਡਕਟ ਵਧੀਆ ਲੱਗਦਾ ਪਿਆ ਸੀ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਇਹ ਪ੍ਰੋਡਕਟ ਵਿੱਚ ਸੁਧਾਰ ਕਰੋ ਜਿਹੜਾ ਆਪਾਂ ਅੱਗੇ ਤੋਂ ਤੁਹਾਡੇ ਕੋਲੋਂ ਹੋਰ ਵੀ ਚੀਜ਼ਾਂ ਮੰਗਵਾ ਸਕੀਏ ਅਤੇ ਜੀ ਇਹਦੇ ਵਿੱਚ ਮੇਰਾ ਇਹ ਤਜਰਬਾ ਵਧੀਆ ਨਹੀਂ ਰਿਹਾ